ਮੈਨੂੰ ਲੱਗਦਾ ਹੈ ਜੀ ਦੌੜਨ ਵਾਲੀ ਕਸਰਤ ਮਾਨਸਿਕ ਸਿਹਤ ਲਈ ਬਹੁਤ ਫਾਇਦੇਮੰਦ ਹੋ ਸਕਦੀ ਆ ਇਹ ਨਾ ਸਿਰਫ ਆਪਣੀ ਸਰੀਰਕ ਸਿਹਤ ਵਿੱਚ ਸੁਧਾਰ ਕਰ ਸਕਦਾ ਹੈ ਬਲਕਿ ਮਾਨਸਿਕ ਤੰਦਰੁਸਤੀ ਵਿੱਚ ਵੀ ਸੁਧਾਰ ਕਰ ਸਕਦਾ ਹੈ ਦੌੜਨ ਅਤੇ ਹੋਰ ਮਾਨਸਿਕ ਲਾਭਾਂ ਵਿੱਚ ਹੈਗੇ ਆ ਜਿਵੇਂ ਕਿ ਆਪਣਾ ਯੋਗਾ ਅਤੇ ਅਸੀਂ ਜਿਵੇਂ ਤੇਜ਼ ਰਫ਼ਤਾਰ ਨਾਲ ਦੌੜਨਾ ਪਸੰਦ ਕਰਦੇ ਹਾਂ ਅਤੇ ਉਹ ਆਪਣੀ ਯਾਦਾਸ਼ਤ ਅਤੇ ਧਿਆਨ ਨੂੰ ਵੀ ਵਧੀਆ ਬਣਾ ਸਕਦਾ ਅਤੇ ਦੂਜਾ ਆਪਣਾ ਕੰਮ 'ਚ ਧਿਆਨ ਲੱਗੂਗਾ ਮਨ ਲੱਗੂਗਾ ਇਹ ਅਤੇ ਤੀਜਾ ਫਿਰ ਆਪਣਾ ਜਿਵੇਂ ਕਿ ਔਰ ਯੋਗਿੰਗ ਦੇ ਨਾਲ ਨਾਲ ਆਪਾਂ ਕਰ ਸਕਦੇ ਹਾਂ ਕਿ ਬਈ ਮੈਡੀਟੇਸ਼ਨ ਜਿਵੇਂ ਹੋ ਗਿਆ ਯੋਗਾ ਕਰ ਲਓ ਉਹ ਧਿਆਨ ਆਪਣੀ ਮਾਨਸਿਕ ਸਿਹਤ ਨੂੰ ਵਧਾਉਂਦਾ ਹੈ ਇਹ ਤਣਾਓ ਨੂੰ ਘਟਾਊਗਾ ਅਤੇ ਵਿੱਚ ਆਪਣੀ ਦਿਮਾਗ ਦੀ ਸੋਚਣ ਸ਼ਕਤੀ ਨੂੰ ਵਧਾਉਣ ਲਈ ਮਦਦ ਕਰੂਗਾ ਅਤੇ ਬਈ ਦੂਜਾ ਧਿਆਨ ਕਰਨ ਲਈ ਕਿਸੇ ਆਪਣਾ ਸ਼ਾਂਤ ਥਾਂ 'ਤੇ ਬਹਿ ਜਾਓ ਆਪਣੀਆਂ ਅੱਖਾਂ ਬੰਦ ਕਰ ਲਓ ਕੁਦਰਤੀ ਤੌਰ 'ਤੇ ਸਾਹ ਲਓ ਅਤੇ ਧਿਆਨ ਕੇਂਦਰਿਤ ਕਰੋ ਅਤੇ ਆਪਣੇ ਆਪ ਜੋ ਹੈਗਾ ਆਪਣਾ ਜੋ ਦਿਮਾਗ ਹੋਊਗਾ ਉਹ ਸ਼ਾਂਤ ਹੋਜੂਗਾ ਅਤੇ ਪਹਿਲਾਂ ਅਸੀਂ ਦੱਸਿਆ ਵੀ ਮੈਡੀਟੇਸ਼ਨ ਕਰ ਸਕਦੇ ਹਾਂ ਬਈ ਯੋਗਿੰਗ ਦੇ ਨਾਲ ਨਾਲ ਅਤੇ ਦੂਜਾ ਆਪਾਂ ਬਈ ਜਿਸ ਕੰਮ 'ਚ ਆਪਣਾ ਮਨ ਲੱਗਦਾ ਆ ਜੇ ਜਿਸ 'ਤੇ ਤੁਸੀਂ ਆਨੰਦ ਲੈਂਦੇ ਹੋ ਜਿਵੇਂ ਕਿ ਆਪਣਾ ਕੋਈ ਪੜ੍ਹਨਾ ਹੋ ਗਿਆ ਬਈ ਕਲਾ ਬਣਾਉਣਾ ਹੋ ਗਿਆ ਬਾਗਵਾਨੀ ਕਰਨਾ ਹੈ ਜਿਹਨੇ ਜਿਹਨੇ ਬਾਈ ਫੋਟੋਗ੍ਰਾਫੀ ਕਰਨਾ ਹੈ ਤਾਂ ਉਹ ਸ਼ੌਕ ਨਾਲ ਜੇ ਜਿਹੜੇ ਆਪਣੇ ਕੰਮ ਹੈਗੇ ਆ ਉਹ ਬੰਦਾ ਕਰੂਗਾ ਤਾਂ ਉਹਨੂੰ ਉੱਧਰ ਕਿ ਆਪਣਾ ਤਣਾਓ ਹੋਊਗਾ ਜੇ ਤਣਾਓ ਕੰਮ ਹੋਊਗਾ ਘਟੇਗਾ ਅਤੇ ਸ਼ੌਕ ਜਿਹੜੇ ਹੈ ਆਪਣੇ ਉਹ ਉੱਤੇ ਸ਼ੌਕ ਵੀ ਤਣਾਓ ਨੂੰ ਘਟਾਉਂਦੇ ਆ ਅਤੇ ਆਪਣੀ ਬੌਧਿਕ ਸ਼ਮਤਾ ਅਤੇ ਵਿਚਾਰ ਅਤੇ ਸੁਧਾਰ ਕਰਦੇ ਹਨ ਅਤੇ ਤੀਜਾ ਬਈ ਆਪਣਾ ਜਿਵੇਂ ਕੁਦਰਤ ਦੇ ਨਾਲ ਰਹਿਣਾ ਵੀ ਚੰਗਾ ਹੁੰਦਾ ਹੈ ਤਣਾਓ ਨੂੰ ਦੂਰ ਕਰਨ ਲਈ ਘੱਟ ਕਰਨ ਲਈ ਅਤੇ ਮੈਂ ਵੀ ਦੌੜਨ ਤੋਂ ਵੱਧ ਆਰਾਮ ਮਹਿਸੂਸ ਕਰਦਾ ਹਾਂ ਇਕਦਮ ਮੇਰਾ ਜੋ ਕੋਨਫੀਡੈਂਸ ਲੈਵਲ ਹੈ ਹੁੰਦਾ ਉਹ ਕੋਨਫੀਡੈਂਟ ਫੀਲ ਕਰਦਾ ਮੈਂ ਪੂਰਾ ਅਤੇ ਬਈ ਸਾਰੀ ਚਿੰਤਾ ਮੁੱਕ ਜਾਂਦੀ ਆ ਜਿਵੇਂ ਕਿ ਆਪਣੇ ਸਾਰੇ ਤਣਾਓ ਮੁੱਕ ਜਾਂਦੇ ਆ ਅਤੇ ਇਸ ਕਰਕੇ ਮੈਨੂੰ ਯੋਗਿੰਗ ਅਤੇ ਰਨਿੰਗ ਬਾਹਲੀ ਚੰਗੀ ਲੱਗਦੀ ਆ ਅਤੇ ਤੁਸੀਂ ਵੀ ਕਰਿਆ ਕਰੋ